ਸਾਨੂੰ ਪਿੰਡ ਵਿੱਚ ਰਹਿਣਾ ਬਹੁਤ ਪਸੰਦ ਜਾਣਾ ਬਹੁਤ ਪਸੰਦ ਲੱਗਦਾ ਸਾਡੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਪਿੰਡ ਵਿੱਚ ਹੀ ਹਨ ਮੇ ਸ ਮੇਰੇ ਨਾਨਕੇ ਪੇਕੇ ਮਾਸੀ ਸਭ ਇਕ ਪਿੰਡ ਵਿੱਚ ਰਹਿੰਦੇ ਹਨ ਅਸੀਂ ਥੜ੍ਹੇ ਟਾਈਮ ਬਾਅਦ ਹੀ ਪਿੰਡ ਗੇੜਾ ਲਗਾਉਂਦੇ ਰਹਿੰਦੇ ਹਾਂ ਸਾਡਾ ਆਪਣਾ ਪਿੰਡ ਵੀ ਲੁਹਾਰਾ ਪਿੰਡ ਹੈ ਜੋ ਕਿ ਸਾਡੇ ਥੋੜ੍ਹੀ ਜਿਹੀ ਦੂਰ ਨਜ਼ਦੀਕ ਹੀ ਹੈ ਅਸੀਂ ਪਿੰਡ ਜਾ ਕੇ ਆਪਣੇ ਖੇਤ ਵਿੱਚ ਗੇੜਾ ਲਗਾਉਂਦੇ ਹਾਂ ਖੇਤ ਵਿੱਚ ਜਾਣਾ ਵੀ ਸਾਨੂੰ ਬਹੁਤ ਪਸੰਦ ਲੱਗਦਾ ਹੈ ਪਿੰਡਾਂ ਦਾ ਮਾਹੌਲ ਖੁੱਲ੍ਹਾ ਵਾਤਾਵਰਣ ਸਾਨੂੰ ਬਹੁਤ ਪਸੰਦ ਲੱਗਦਾ ਹੈ ਪਿੰਡਾਂ ਵਿੱਚ ਘਰ ਦੀਆਂ ਸਬਜ਼ੀਆਂ ਘਰ ਦਾ ਦੁੱਧ ਘਿਓ ਜੋ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਸ਼ਹਿਰਾਂ ਵਿੱਚ ਜੋ ਕਿ ਸਭ ਮਿਲਾਵਟ ਵਾਲੀਆਂ ਚੀਜ਼ਾਂ ਮਿਲਦੀਆਂ ਹਨ ਸਾਡੇ ਬੱਚੇ ਵੀ ਪਿੰਡ ਵਿੱਚ ਜਾ ਕੇ ਖੂਬ ਇੰਜੋਏ ਕਰਦੇ ਹਨ ਉਹਨਾਂ ਨੂੰ ਪਿੰਡ ਵਿੱਚ ਰਹਿਣਾ ਵੀ ਬਹੁਤ ਵਧੀਆ ਲੱਗਦਾ ਹੈ ਖੁੱਲ੍ਹੇ ਵਿਹੜੇ ਜਿਹਨਾਂ ਵਿੱਚ ਬੱਚਿਆਂ ਨੂੰ ਖੇਡਣਾ ਬਹੁਤ ਪਸੰਦ ਹੈ ਇਸ਼ ਇਸ ਪਿੰਡਾਂ ਵਿੱਚ ਲੋਕ ਮਿਲ ਵਰਤ ਕੇ ਰਹਿੰਦੇ ਹਨ ਪਿੰਡਾਂ ਦਾ ਮਾਹੌਲ ਖੁੱਲ੍ਹਾ ਡੁੱਲ੍ਹਾ ਹੁੰਦਾ ਹੈ ਪਿੰਡ ਵਿੱਚ ਹਰ ਤਰ੍ਹਾਂ ਦੀ ਚੀਜ਼ ਲੋਕ ਕੋਈ ਸਬਜ਼ੀ ਫਰੂਟ ਆਪਣੇ ਖੇਤ ਵਿੱਚ ਉਗਾਉਂਦੇ ਹਨ ਅਤੇ ਖਾਂਦੇ ਹਨ ਸ਼ਹਿਰ ਵਿੱਚ ਜੋ ਵੀ ਸਬਜ਼ੀ ਆਉਂਦੀ ਹੈ ਉਹ ਸਭ ਰੇਹਾਂ ਸਪਰੇਹਾਂ ਵਾਲੀ ਔਰ ਕੈਮੀਕਲ ਵਾਲੀ ਹੁੰਦੀ ਹੈ ਪਿੰਡਾਂ ਵਿੱਚ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਮੇਰੇ ਸਾਰੇ ਰਿਸ਼ਤੇਦਾਰ ਪਿੰਡਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਮਿਲ ਜਿੰਨ੍ਹਾਂ ਕੋਲ ਜਾਣਾ ਸਾਨੂੰ ਪਿੰਡ ਵਿੱਚ ਬਹੁਤ ਜ਼ਿਆਦਾ ਪਸੰਦ ਹੈ ਸਾਡੇ ਬੱਚਿਆਂ ਨੂੰ ਵੀ ਪਿੰਡ ਵਿੱਚ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ